ਮੇਰੀ ਜ਼ਿੰਦਗੀ ਦੀ ਸਭ ਤੋਂ ਅਲੀਸ਼ਾਨ ਯਾਤਰਾ ਤਕਰੀਬਨ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਵੈਸ਼ਨੋ ਮਾਤਾ ਦੀ ਰਹੀ ਹੈ ਉੱਥੇ ਮੈਂ ਫਰਵਰੀ ਦੇ ਮਹੀਨੇ ਵਿੱਚ ਗਿਆ ਸੀ ਇੱਕ ਤਾਂ ਮੌਸਮ ਬਹੁਤ ਹੀ ਵਧੀਆ ਸੀ ਦੂਸਰਾ ਪੁਰਾਣੀ ਗੁਫ਼ਾ ਜੋ ਕਿ ਬਹੁਤ ਹੀ ਘੱਟ ਖੁੱਲ੍ਹੀ ਹੁੰਦੀ ਹੈ ਉਹ ਖੁੱਲ੍ਹੀ ਹੋਈ ਸੀ ਮੈਨੂੰ ਆਪਣੀ ਉਸ ਗੁਫ਼ਾ 'ਚ ਜਾਣ ਦਾ ਪਹਿਲੀ ਵਾਰੀ ਸੁਭਾਗਿਆ ਪ੍ਰਾਪਤ ਹੋਇਆ ਮੈਂ ਉੱਥੇ ਜਦੋਂ ਅੰਦਰ ਗਿਆ ਤਾਂ ਮੈਨੂੰ ਮ ਇੱਦਾਂ ਲੱਗਿਆ ਜਿਵੇਂ ਮਾਤਾ ਰਾਣੀ ਸਿੱਧੀ ਮੇਰੇ 'ਤੇ ਕਿਰਪਾ ਕਰ ਰਹੀ ਹੈ ਮੈਨੂੰ ਇੰਨਾ ਵਧੀਆ ਮਹਿਸੂਸ ਹੋਇਆ ਕਿ ਮੈਂ ਬਿਆਨ ਨਹੀਂ ਕਰ ਸਕਦਾ ਦੂਸਰਾ ਉਸ ਉਹ ਉਦੋਂ ਫਰਵਰੀ ਮਾ ਮਹੀਨੇ ਦੇ ਵਿੱਚ ਮੈਨੂੰ ਗਰਭ ਜੂਨ ਜੋ ਕਿ ਅੱਧਕਵਾਰੀ ਦੇ ਵਿੱਚ ਵੀ ਆਉਂਦੀ ਹੈ ਉੱਥੇ ਵੀ ਮੈਂ ਹੋ ਕੇ ਆਇਆ ਤੰਗ ਜਿਹੀ ਗੁਫ਼ਾ ਹੋਣ ਦੇ ਬਾਵਜੂਦ ਵੀ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਮੈਂ ਇਸ ਗੁਫ਼ਾ ਦੇ ਵਿੱਚੋਂ ਨਹੀਂ ਨਿਕਲ ਸਕਦਾ ਪਰ ਮਾਤਾ ਰਾਣੀ ਨੇ ਅਜਿਹੀ ਕਿਰਪਾ ਕੀਤੀ ਅਜਿਹੀ ਕਿਰਪਾ ਕੀਤੀ ਕਿ ਮੈਂ ਬਹੁਤ ਹੀ ਸੌਖੇ ਅਤੇ ਆਰਾਮ ਨਾਲ ਉਸ ਗੁਫ਼ਾ ਦੇ ਵਿੱਚੋਂ ਨਿਕਲ ਗਿਆ ਅਤੇ ਜੈਕਾਰਾਂ ਮਾਂ ਸ਼ੇਰਾਂ ਵਾਲੀ ਦੇ ਬੋਲਦੇ ਹੋਏ ਮੈਂ ਬਾਹਰ ਆਇਆ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜਿਹੜੀ ਇਹ ਯਾਤਰਾ ਬਹੁਤ ਲੰਬੇ ਸਮੇਂ ਤੱਕ ਯਾਦ ਰਹੇਗੀ